ਸੋਸ਼ਲ ਮੀਡੀਆ 'ਤੇ ਕਿਸੇ ਦੀ ਫੋਟੋ ਦਾ ਗਲਤ ਇਸਤੇਮਾਲ ਨਹੀਂ ਕਰ ਸਕਦੇ ਕਿਸੇ ਦੀ ਫੋਟੋ ਅਸੀਂ ਉਹਦੀ ਬਿਨਾਂ ਅਨੁਮਤੀ ਤੋਂ ਵਰਤ ਨਹੀਂ ਸਕਦੇ ਕਿਸੇ ਦੀ ਫੋਟੋ 'ਤੇ ਅਸੀਂ ਕੋਈ ਗਲਤ ਕਮੈਂਟ ਨਹੀਂ ਕਰ ਸਕਦੇ ਕਿਸੇ ਦੀ ਫੋਟੋ ਜੋ ਸੋਸ਼ਲ ਮੀਡੀਆ 'ਤੇ ਹੋਈ ਹੈ ਉਹਦੀ ਅਸੀਂ ਗਲਤ ਪ੍ਰਯੋਗ ਨਹੀਂ ਕਰ ਸਕਦੇ ਸੋ ਇਸ ਕਰਕੇ ਸੋਸ਼ਲ ਮੀਡੀਆ ਜਿਹੜਾ ਹੈ ਉਹ ਕਿਸੇ ਵੀ ਦੁਰਵਰਤੋਂ ਕਰਨ ਵਿੱਚ ਜੋ ਸਹੀ ਢੰਗ ਨਹੀਂ ਹੈ ਸੋ ਇਸ ਕਰਕੇ ਸੋਸ਼ਲ ਮੀਡੀਆ 'ਤੇ ਕਦੇ ਵੀ ਕਿਸੇ ਦੀ ਫੋਟੋ ਦਾ ਗਲਤ ਇਸਤੇਮਾਲ ਨਹੀਂ ਕਰਨਾ ਚਾਹੀਦਾ